ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਤਾਰ੍ਹਾਂ ਸੌ ਅੱਸੀ ਵਿੱਚ ਹੋਇਆ ਜਿਨ੍ਹਾਂ ਨੇ ਆਪਣੇ ਆਪ ਨੂੰ ਲਾਹੌਰ ਦਾ ਰਾਜਾ ਅਠਾਰ੍ਹਾਂ ਸੌ ਇੱਕ ਵਿੱਚ ਘੋਸ਼ਿਤ ਕੀਤਾ ਇਹਨਾਂ ਦੇ ਦਰਬਾਰ ਵਿੱਚ ਇੱਕ ਮੁਸਲਿਮ ਮੰਤਰੀ ਸਨ ਅਤੇ ਇੱਕ ਬਾਹਮਣ ਉਹ ਵੀ ਜੋ ਮੰਤਰੀ ਸੀ ਇਹਨਾਂ ਦਾ ਇਹਨਾਂ ਦੇ ਰਾਜ ਦੇ ਟੈਮ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਸਮਾਨ ਮੰਨਿਆ ਜਾਂਦਾ ਸੀ ਅਤੇ ਸਾਰੇ ਹੀ ਬਹੁਤ ਪਿਆਰ ਸਤਿਕਾਰ ਨਾਲ ਰਹਿੰਦੇ ਸੀ ਇਹਨਾਂ ਨੇ ਆਪਣੀ ਫੌਜ ਨੂੰ ਬਹੁਤ ਮੋਡਰਨ ਢੰਗਾਂ ਨਾਲ ਤਿਆਰ ਕੀਤਾ ਹੋਇਆ ਸੀ ਇਹਨਾਂ ਨੇ ਜੋ ਛੋਟੇ ਰਾਜ ਸੀ ਸਾਰੇ ਰਾਜ ਨੂੰ ਇਕੱਠਾ ਕਰਕੇ ਇੱਕ ਵੱਡਾ ਰਾਜ ਕਾਇਮ ਕੀਤਾ ਇਹਨਾਂ ਦੇ ਟੈਮ ਅੰਗਰੇਜ਼ ਭਾਰਤ ਵਿੱਚ ਹੀ ਸੀ ਪਰ ਅੰਗਰੇਜ਼ ਇਹਨਾਂ ਤੋਂ ਡਰਦੇ ਸੀ ਕਿਉਂਕਿ ਇਹਨਾਂ ਦਾ ਦਬਦਬਾ ਬਹੁਤ ਵੱਡਾ ਸੀ ਅਤੇ ਇਹ ਬਹੁਤ ਪਾਵਰਫੁੱਲ ਵੀ ਸਨ ਅਤੇ ਇਹਨਾਂ ਕੋਲ ਉਸ ਟਾਇਮ 'ਚ ਕਾਫੀ ਮੋਡਰਨ ਜ਼ਮਾਨੇ ਦੇ ਹਥਿਆਰ ਵੀ ਸਨ ਅਤੇ ਹਥਿਆਰ ਚਲਾਉਣ ਵਾਲੇ ਚੰਗੇ ਨਿਸ਼ਾਨੇਬਾਜ਼ ਵੀ ਸਨ ਇਹ ਆਪਣੇ ਆਪ ਨੂੰ ਕਦੀ ਵੀ ਦੂਜਿਆਂ ਉੱਪਰ ਹਾਵੀ ਨਹੀਂ ਸੀ ਕਰਦੇ ਇਹ ਹਰ ਇੱਕ ਦੀ ਗੱਲ ਮੰਨਦੇ ਸਨ ਅਤੇ ਦੋਸ਼ੀਆਂ ਨੂੰ ਕੜੀ ਸਜ਼ਾ ਦਿੰਦੇ ਸਨ ਇਹਨਾਂ ਨੇ ਰਾਜ ਕਾਇਮ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਇੱਕ ਚੰਗਾ ਨਾਗਰਿਕ ਬਣਾਇਆ ਇਹਨਾਂ ਦੀ ਅਧਰੰਗ ਕਾਰਨ ਅਠਾਰ੍ਹਾਂ ਸੌ ਉਨਤਾਲੀ ਵਿੱਚ ਮ੍ਰਿਤੂ ਹੋ ਹੋ ਗਈ ਸੀ